ਹੈਲੋ ਹਾਂਜੀ ਹਾਂਜੀ ਵੀਰੇ ਪੀਜੀ ਬਾਰੇ ਪੁੱਛਣਾ ਸੀ

ਮੈਂ ਪੰਜਾਬੀ ਯੂਨੀਵਰਸਿਟੀ ਦਾ ਸਟੂਡੈਂਟ ਬੋਲ ਰਿਹਾ ਸੀ ਐਕਚੁਲੀ ਮੇਰੀ ਲਾਸਟ ਈਅਰ ਦੀ ਇੱਥੇ ਐਡਮਿਸ਼ਨ ਹੋਈ ਸੀ ਅਤੇ ਮੈਂ ਤੁਹਾਨੂੰ ਪੁੱਛਣਾ ਜੀ ਪੀਜੀ ਬਾਰੇ ਕੋਈ ਪੰਜਾਬੀ ਯੂਨੀਵਰਸਿਟੀ ਦੇ ਆਸ ਪਾਸ ਹੋਵੇ ਜੀ ਮੇਰੀ ਰਿਹਾਇਸ਼ ਹੈਗੀ ਹਿਮਾਚਲ ਦੀ ਹਾਂਜੀ ਵੈਸੇ ਨੇੜੇ ਕਰ ਦਿਓ ਤਾਂ ਵਧੀਆ ਜੀ ਹਾਂਜੀ ਠੀਕ ਹੈ ਜੀ ਮਤਲਬ ਇੱਥੇ ਜੀ

ਪ੍ਰਾਈਜ਼ ਕੀ ਹੋਵੇਗਾ ਰੈਂਟ ਠੀਕ ਹੈ ਜੀ ਓਕੇ ਜੀ ਓਕੇ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਓਕੇ ਕੁਛ ਪੈਸੇ ਦੀ ਸਿੰਗਲ ਰੂਮ ਚਾਹੀਦਾ

ਠੀਕ ਜੀ ਠੀਕ ਹੈ ਇਹਦਾ ਰੈਂਟ ਦੱਸ ਪ੍ਰਾਈਜ਼ ਥੋੜ੍ਹਾ ਘੱਟ ਕਰਾ ਦਿਓ ਜੀ ਠੀਕ ਹੈ ਜੀ